ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਬਹੁਤ ਸਾਰੇ ਤਿਉਹਾਰ ਬੜੀ ਸ਼ਰਧਾ ਅਤੇ ਭਾਵਨਾ ਨਾਲ਼ ਮਨਾਏ ਜਾਂਦੇ ਹਨ ਇਹ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ਼ ਮਨਾਏ ਜਾਂਦੇ ਹਨ ਸਾਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਜਨਵਰੀ ਵਿੱਚ ਆਉਂਦਾ ਹੈ ਇਹ ਗੁ ਗੁਰੂ ਸਾਹਿਬ ਦਾ ਜਨਮ ਦਿਹਾੜਾ ਜਿਹੜਾ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਸੈਕਿੰਡ ਗੱਲ ਕਰੀਏ ਤਾਂ ਅਪ੍ਰੈਲ 'ਚ ਵਿਸਾਖੀ ਵਿਸਾਖੀ ਦਾ ਤਿਉਹਾਰ ਸਿੱਖਾਂ ਲਈ ਕਿਸਾਨਾਂ ਲਈ ਅਤੇ ਹੋਰ ਲੋਕਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਇਸ ਦਿਨ ਕਿਸਾਨ ਜ਼ਿਆਦਾਤਰ ਆਪਣੀ ਵਾਢੀ ਸ਼ੁਰੂ ਕਰਦੇ ਨੇ ਕਣਕਾਂ ਦੀ ਵਾਢੀ ਹੁੰਦੀ ਹੈ ਇਸ ਦਿਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਸਿੱਖੀ ਦੀ ਨੀਂਹ ਰੱਖੀ ਸੀ ਅਤੇ ਹੋਰ ਬਹੁਤ ਸਾਰੇ ਤਿਉਹਾਰ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਬਹੁਤ ਸਾਰੇ ਇਤਿਹਾਸ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਆਪਣੀ ਸ਼ਰਧਾ ਭਾਵਨਾ ਨਾਲ਼ ਮਨਾਉਂਦੇ ਨੇ ਜੇਕਰ ਅਸੀਂ ਗੱਲ ਕਰੀਏ ਦੁਸਹਿਰੇ ਦੀ ਦੁਸਹਿਰਾ ਇੱਕ ਨੇਕੀ ਅਤੇ ਬਦੀ ਦਾ ਤਿਉਹਾਰ ਹੈ ਜਿਹਨੂੰ ਕਿ ਹਰ ਸਾਲ ਬੜੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਇਸ ਦਿਨ ਰਾਵਣ ਦੇ ਪੁਤਲੇ ਨੂੰ ਸਾੜਿਆ ਜਾਂਦਾ ਹੈ ਪਰ ਮੈਨੂੰ ਇਸ ਗੱਲ 'ਤੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਰਾਵਣ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਬਲਵਾਨ ਵਿਅਕਤੀ ਸੀ ਪਰ ਫਿਰ ਵੀ ਉਹਨੂੰ ਉਹ ਕਹਿੰਦੇ ਨਾ ਘਰ ਦਾ ਭੇਤੀ ਲੰਕਾ ਢਾਹੇ ਫਿਰ ਆਪਣੇ ਘਰ ਦੇ ਕਰਕੇ ਹੀ ਉਹ ਮਾਰਿਆ ਗਿਆ ਅਤੇ ਦੂਜੀ ਗੱਲ ਕਰੀਏ ਜੇ ਦੀਵਾਲੀ ਦੀ ਅਤੇ ਦੀਵਾਲੀ ਮੇਰਾ ਫੇਵਰੇਟ ਤਿਉਹਾਰ ਹੈ ਜਿਹਨੂੰ ਕਿ ਰੌਸ਼ਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਕਿ ਜਿਹਦੇ ਵਿੱਚ ਬੰਦਾ ਆਪਣੀ ਮਨਪਸੰਦ ਦੀ ਹਰ ਚੀਜ਼ ਨੂੰ ਇੰਜੋਏ ਕਰਦਾ ਹੈ ਕ ਜੇ ਲਈਏ ਤਾਂ ਖਾਣੇ ਨੂੰ ਇਨਜੋਏ ਕਰਦਾ ਹੈ ਆਪਣੀ ਖੁਸ਼ੀ ਨੂੰ ਦੂਜਿਆਂ ਅੱਗੇ ਰੱਖਦਾ ਹੈ ਹਰੇਕ ਦੀ ਖੁਸ਼ੀ 'ਚ ਸ਼ਾਮਿਲ ਹੁੰਦਾ ਹੈ ਮੈਨੂੰ ਬਹੁਤ ਚੰਗਾ ਲੱਗਦਾ ਹੈ ਦੀਵਾਲੀ ਮਨਾਉਣਾ ਮੈਂ ਹਰ ਸਾਲ ਬਹੁਤ ਵਧੀਆ ਢੰਗ ਨਾਲ ਦੀਵਾਲੀ ਮਨਾਉਂਦੀ ਹਾਂ ਕਿਉਂਕਿ ਅਸੀਂ ਸਵੇਰੇ ਉੱਠਦੇ ਹਾਂ ਪਾਠ ਪੂਜਾ ਕਰਦੇ ਹਾਂ ਅਤੇ ਹਰ ਸਾਲ ਪਟਾਕੇ ਲਿਆਉਂਦੇ ਹਾਂ ਚਲਾਉਂਦੇ ਹਾਂ ਫੈਮਲੀ ਨਾਲ਼ ਇੰਜੋਏ ਕਰਦੇ ਹਾਂ ਅਤੇ ਦੀਵਾਲੀ ਵਾਲੇ ਦਿਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਵੰਜਾ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾਇਆ ਸੀ ਜਿਨ੍ਹਾਂ ਦੀ ਯਾਦ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਹੋਰ ਵੀ ਬਹੁਤ ਸਾਰੇ ਤਿਉਹਾਰ ਨੇ ਜਿਨ੍ਹਾਂ ਨੂੰ ਲੋਕ ਬਹੁਤ ਹੀ ਸ਼ਰਧਾ ਨਾਲ਼ ਮਨਾਉਂਦੇ ਨੇ ਜੇਕਰ ਕਰਵਾਚੌਥ ਦੀ ਗੱਲ ਕਰੀਏ ਤਾਂ ਉਹ ਔਰਤਾਂ ਦਾ ਇੱਕ ਅਜਿਹਾ ਤਿਉਹਾਰ ਹੈ ਜਿਹਨੂੰ ਬਹੁਤ ਹੀ ਖੁਸ਼ੀ ਖੁਸ਼ੀ ਮਨਾਉਂਦੀਆਂ ਨੇ ਅਤੇ ਇਹਦੇ ਵਿੱਚ ਉਹ ਕਰਵਾ ਮਾਤਾ ਦੀ ਪੂਜਾ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਸੁੱਖ ਮੰਗਦੀਆਂ ਹਨ